ਜਿਵੇਂ ਕਿ ਅੱਜ ਕੱਲ੍ਹ ਕਿਸਾਨ ਖੇਤੀਬਾੜੀ ਜੀਰੀ ਹੋਰ ਫਸਲ ਉਗਾਉਂਦਾ ਹੈ ਬਾਅਦ ਵਿੱਚ ਉਹਨੂੰ ਕੱਟ ਲੈਂਦਾ ਹੈ ਕੱਟਣ ਤੋਂ ਬਾਅਦ ਉਸਦੇ ਰਹਿੰਦ ਖੂੰਹਦ ਉਹ ਰਹਿ ਜਾਂਦੀ ਹੈ ਜਾਂ ਤਾਂ ਫਿਰ ਉਹਨੂੰ ਅੱਗ ਲਾਉਣੀ ਪੈਂਦੀ ਹੈ ਜੇ ਅੱਗ ਲਾਉਂਦਾ ਹੈ ਤਾਂ ਉਸਦੀ ਧੂੰਆਂ ਹੁੰਦਾ ਪ੍ਰਦੂਸ਼ਣ ਹੁੰਦਾ ਉਹ ਲੋਕਾਂ ਨੂੰ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਉਸਦਾ ਸਥਿਰ ਹੱਲ ਕੱਢਣਾ ਚਾਹੀਦਾ ਹੈ ਜਿਸ ਨਾਲ ਇਹ ਧੂੰਆਂ ਜਾਂ ਹੋਰ ਇਹ ਨਹੀਂ ਹੋਣਾ ਚਾਹੀਦਾ ਜੇ ਅੱਗ ਲਾਉਂਦਾ ਹੈ ਤਾਂ ਉਸਦੀ ਅਤੇ ਉਸਦੀ ਨਾਈਟ੍ਰੋਜਨ ਖਤਮ ਹੋ ਜਾਂਦੀ ਹੈ ਜਿਵੇਂ ਕਿ ਉਸ ਦੇ ਵਿੱਚ ਕਣ ਹੁੰਦੇ ਨੇ ਜ਼ਮੀਨ ਦੇ ਵਿੱਚ ਗੰਡ ਗੰਡੋਲੇ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਉਸ ਨੇ ਹੀ ਇਸ ਖੇਤੀ ਨੂੰ ਪ੍ਰਫੁੱਲਤਾ ਦੇਣੀ ਹੁੰਦੀ ਹੈ ਪਰ ਸਾਨੂੰ ਇਹ ਚਾਹੀਦਾ ਹੈ ਕਿ ਰਹਿੰਦ ਖੂੰਹਦ ਨੂੰ ਇੱਕ ਟੋਆ ਪੱਟ ਕੇ ਜਾਂ ਉਸ ਦੇ ਵਿੱਚ ਦੱਬ ਕੇ ਉਸਦੇ ਵਿੱਚ ਪਾਣੀ ਪਾ ਕੇ ਉਸਦਾ ਰੇਹ ਬਣਾਉਣਾ ਚਾਹੀਦਾ ਤਾਂ ਕਿ ਇਸ ਦਾ ਸਹੀ ਹੱਲ ਹੋ ਜਾਵੇ ਪਰ ਸਾਨੂੰ ਸਰਕਾਰ ਇਹ ਸ ਸ ਸਾਥ ਦੇਣਾ ਚਾਹੀਦਾ ਤਾਂ ਕਿ ਅਸੀਂ ਇਸ ਨੂੰ ਵਧੀਆ ਤਰੀਕੇ ਨਾਲ ਹੱਲ ਕਰ ਸਕੀਏ